ਰਸੋਈ ਵਿੱਚ ਕਿੰਨੇ ਤਰ੍ਹਾਂ ਦੇ ਬਰਤਨ ਪਾਏ ਜਾਂਦੇ ਆ ਪਰ ਹਰ ਬਰਤਨ ਵਾਸਤੇ ਹਰ ਚੀਜ਼ ਨੂੰ ਯੂਸ ਕਰਨ ਵਾਸਤੇ ਅਲੱਗ ਹੀ ਬਰਤਨ ਹੈ ਜਿੱਦਾਂ ਹੁਣ ਮੈਨੂੰ ਕੋਈ ਤੜਕਾ ਲਾਉਣਾ ਹੈ ਉਹਦੇ ਵਾਸਤੇ ਸਭ ਤੋਂ ਪਹਿਲੀ ਚੀਜ਼ ਮੈਨੂੰ ਕੀ ਚਾਹੀਦੀ ਕੜਾਹੀ ਕੜਾਹੀ ਚਾਹੀਦੀ ਹੈ ਕੜਾਹੀ ਨੂੰ ਦੇ ਵਿੱਚ ਕੋਈ ਚੀਜ਼ ਬਣਾਉਣ ਵਾਸਤੇ ਇਸ ਹਿਲਾਉਣ ਵਾਸਤੇ ਸਾਨੂੰ ਕੜਛੀ ਦੀ ਲੋੜ ਪੈਂਦੀ ਹੈ ਇਸ ਤਰ੍ਹਾਂ ਹੁਣ ਰੋਟੀ ਖਾਣੀ ਹੈ ਰੋਟੀ ਬਣਾਉਣ ਵਾਸਤੇ ਸਾਨੂੰ ਚੱਕਲਾ ਵੇਲਣਾ ਅਤੇ ਤਵੇ ਦਾ ਯੂਸ ਹੋਏਗਾ ਅਤੇ ਤਵੇ ਨੂੰ ਤਵੇ ਵਿੱਚ ਰੋਟੀ ਬਣਾਉਣ ਵਾਸਤੇ ਅਸੀਂ ਸਟੋਵ ਯੂਸ ਕਰਦੇ ਹਾਂ ਫਿਰ ਪਾਣੀ ਪੀਣਾ ਹੈ ਤਾਂ ਸਾਨੂੰ ਗਲਾਸ ਦੀ ਯੂਸ ਕਰਨੀ ਪੈਂਦੀ ਹੈ ਮਤਲਬ ਹਰ ਬਰਤਨ ਵਾਸਤੇ ਸਾਨੂੰ ਕੋਈ ਵੀ ਚੀਜ਼ ਯੂਸ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਬਰਤਨ ਇੱਦਾਂ ਜਿਹਾ ਚਾਹੀਦਾ ਹੈ ਹੁਣ ਇੱਕ ਕੌਲੀ ਹੋਏਗੀ ਅਤੇ ਅਸੀਂ ਕੋਈ ਵੀ ਜਿੱਦਾਂ ਲਿਕੁਇਡ ਵਾਲੀ ਚੀਜ਼ ਹੁੰਦੀ ਹੈ ਉਹ ਅਸੀਂ ਕੌਲੀ 'ਚ ਪਾ ਕੇ ਆਰਾਮ ਨਾਲ ਖਾ ਸਕਦੇ ਹਾਂ ਪਲੇਟ ਹੈ ਪਲੇਟ ਦੇ ਵਿੱਚ ਅਸੀਂ ਰੋਟੀ ਚਾਵਲ ਪਾ ਕੇ ਖਾ ਸਕਦੇ ਹਾਂ ਉਹਦੇ ਬਾਅਦ ਅੱਜ ਕੱਲ੍ਹ ਕਿੰਨੀਆਂ ਕੁ ਸਾਨੂੰ ਉਪਲਬਧ ਹੈਗੀਆਂ ਐ ਤੜਕਾ ਕੱਟਣ ਵਾਸਤੇ ਸਾਨੂੰ ਕੋਈ ਗ੍ਰੈਂਡਰ ਬਲੈਂਡਰ ਮਿਲ ਜਾਂਦਾ ਹੈ ਕੋਈ ਪੀਸਣ ਵਾਸਤੇ ਸਾਨੂੰ ਮਿਕਸੀ ਮਿਲੀ ਹੋਈ ਹੈ ਇੱਦਾਂ ਜਿਹੀਆਂ ਕਿੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਰਸੋਈ 'ਚ ਸਾਡੇ ਵਾਸਤੇ ਬਰਤਨ ਦੇ ਤੌਰ 'ਚ ਵੀ ਯੂਸ ਆ ਸਕਦੀ ਹੈ